ਮੈਂ ਨਰਸਿੰਗ ਦੀ ਸਟੂਡੈਂਟ ਹੈ ਅਤੇ ਮੇਰਾ ਮਨਪਸੰਦ ਇਹ ਹੈ ਕਿ ਮਤਲਬ ਮੈਂ ਨਰਸਿੰਗ ਕਰਾਂ ਮਤਲਬ ਮੈਨੂੰ ਨਰਸਿੰਗ ਬਹੁਤ ਹੀ ਜ਼ਿਆਦਾ ਪਸੰਦ ਹੈ ਇਹਦੇ 'ਚ ਮੈਂ ਮਤਲਬ ਮੈਨੂੰ ਉਹ ਮਤਲਬ ਹੈਲਥ ਬਾਰੇ ਲੱਗਦਾ ਹੈ ਮਤਲਬ ਮੈਂ ਮਤਲਬ ਇਸ 'ਚ ਰਿਸਰਚ ਹੁੰਦੇ ਹੈ ਮਤਲਬ ਜਿਹੜੇ ਵੀ ਬੀਮਾਰੀ ਹੁੰਦੀ ਹੈ ਉਹਦੇ ਬਾਰੇ ਪਤਾ ਲੱਗਦਾ ਹੈ ਕਿ ਮਤਲਬ ਕਿਵੇਂ ਠੀਕ ਕਰ ਸਕਦੇ ਹੈ ਮਤਲਬ ਇਹਦੇ ਕੋਜਿਜ਼ ਮਤਲਬ ਕਾਰਨ ਕਿਆ ਹੋ ਸਕਦੇ ਹੈ ਮਤਲਬ ਸਾਈਡ ਇਫੈਕਟ ਕਿਆ ਸਕ ਹੋ ਸਕਦੇ ਮਤਲਬ ਮਤਲਬ ਕੋਈ ਮਤਲਬ ਐਕਸਪਾਈਰੀ ਡੇਟ ਹੁੰਦਾ ਤਾਂ ਫਿਰ ਉਸ ਦੇ ਸਾਈਡ ਇਫੈਕਟ ਕਿਆ ਹੋ ਸਕਦੇ ਜੇ ਅਸੀਂ ਖਾ ਸਕਦੇ ਹੈ ਅਤੇ ਮਤਲਬ ਮਤਲਬ ਹੁੰਦਾ ਹੈ ਕਿ ਮਤਲਬ ਹੈਲਥ ਬਾਰੇ ਕਿ ਮਤਲਬ ਦੂਜਿਆਂ ਦੀ ਮਤਲਬ ਸਿਹਤ ਜੇ ਕੋਈ ਪੁੱਛਦਾ ਵੀ ਹੈ ਸਾਡੇ ਤੋਂ ਮਤਲਬ ਆਸਾਨੀ ਨਾਲ਼ ਦੱਸ ਵੀ ਸਕਦੇ ਹਾਂ ਮ ਕਿਹੜੀ ਗੋਲ਼ੀ ਲੈਣੀ ਚਾਹੀਦੀ ਹੈ ਅਤੇ ਕਿ ਕਿਹੜੀ ਨਹੀਂ ਲੈਣੀ ਚਾਹੀਦੀ ਹੈ ਅਤੇ ਮਤਲਬ ਬਹੁ ਮਤਲਬ ਇਹ ਇਹ ਮੈਂ ਤਾਂ ਮਤਲਬ ਹੁੰਦਾ ਕਿ ਮਤਲਬ ਇਹਦੇ 'ਚ ਜੋਬ ਵਗੈਰਾ ਵੀ ਮਤਲਬ ਮਤਲਬ ਬਹੁਤ ਆਸਾਨੀ ਨਾਲ਼ ਮਿਲ ਸਕਦਾ ਮੈਂ ਰਾਤ ਨੂੰ ਵੀ ਮਤਲਬ ਇੱਕ ਬੁੱਕ ਪੜ੍ਹੀ ਸੀ ਅਨੈਰੀਟੀਮੇਵਲ ਉਹਦੇ 'ਚ ਤਾਂ ਸਾਨੂੰ ਮਤਲਬ ਹੈਲਥ ਬਾਰੇ ਪਤਾ ਲੱਗਦਾ ਹੈ ਮਤਲਬ ਸਾਰਾ ਬੌਡੀ ਰੀਲੇਟਿਡ ਹੋਤਾ ਮਤਲਬ ਜ ਜਿਵੇਂ ਬਾਇਓ ਹੁੰਦਾ ਹੈ ਉਹਦੇ ਨਾਲ ਉਹਦੇ ਹੁੰਦਾ ਹੈ ਮਤਲਬ ਪਹਿਲਾਂ ਤਾਂ ਮਤਲਬ ਸਟਾਰਟਿੰਗ ਕਰ ਦਿੱਤੀ ਮਤਲਬ ਜਿਸ ਜਿਵੇਂ ਮਤਲਬ ਹੈੱਡ ਤੋਂ ਲੈ ਕੇ ਮਤਲਬ ਹੈੱਡ 'ਚ ਮਤਲਬ ਕਿ ਕਿਆ ਕਿਆ ਪਾ ਬੌਡੀ ਪਾਰਟਸ ਹੁੰਦੇ ਹੈ ਮਤਲਬ ਇਹਦੇ ਮਤਲਬ ਕਿੱਦਾਂ ਮਤਲਬ ਫ੍ਰੈਕਚਰ ਵਗੈਰਾ ਹੁੰਦਾ ਹੈ ਫਿਰ ਕਿਆ ਹੁੰਦਾ ਅਤੇ ਇਹ ਇਹ ਉੱਦਾਂ ਹੀ ਮਤਲਬ ਸਾਡੇ ਮਤਲਬ ਥੱਲੇ ਦੇ ਪਾਰਟ ਹੁੰਦੇ ਜਿਹੜੇ ਬੌਡੀ ਦੇ ਉਹਦੇ ਬਾਰੇ ਪਤਾ ਹੁੰਦਾ ਹੈ